ਅਗਰ ਅਸੀਂ ਆਪਣੀ ਮਾਂ ਬੋਲੀ ਦੀ ਮਹੱਤਤਾ ਬਾਰੇ ਗੱਲ ਕਰਨੀ ਹੋਵੇ ਤਾਂ ਮਾਂ ਬੋਲੀ ਆਪਾਂ ਉਸ ਨੂੰ ਕਹਿੰਦੇ ਹਾਂ ਕਿ ਜਿਹੜੀ ਬੰਦਾ ਆਪਣੇ ਮਾਂ ਦੀ ਵੀ ਕੁੱਖ ਵਿੱਚੋਂ ਪੈਦਾ ਹੋਣ ਸਾਰ ਹੀ ਜਿਹੜੀ ਚੀਜ਼ ਆਪਣੇ ਇਨਵਾਇਰਮੈਂਟ ਅਤੇ ਆਪਣੇ ਮਾਂ ਦੇ ਦੁੱਧ ਤੋਂ ਸਿੱਖਦਾ ਹੈ ਅਤੇ ਅਗਰ ਮੈਂ ਪੰਜਾਬੀ ਮਾਤ ਭਾਸ਼ਾ ਦੀ ਗੱਲ ਕਰਾਂ ਤਾਂ ਪੰਜਾਬੀ ਮਾਤ ਭਾਸ਼ਾ ਨੂੰ ਬੋਲਣ ਵਾਲੇ ਲੋਕ ਭਾਰਤੀ ਪੰਜਾਬ ਪਾਕਿਸਤਾਨੀ ਪੰਜਾਬ ਅਤੇ ਦੁਨੀਆ ਭਰ ਵਿੱਚ ਅਗਰ ਅਸੀਂ ਇਸ ਦੀ ਗਿਣਤੀ ਕਰੀਏ ਲਗਭਗ ਛੇ ਸੱਤ ਕਰੋੜ ਲੋਕ ਹਨ ਜਿਹੜੇ ਕਿ ਪੰਜਾਬੀ ਭਾਸ਼ਾ ਬੋਲ ਰਹੇ ਹਨ ਪਰੰਤੂ ਆਧੁਨਿਕ ਸਮੇਂ ਦੇ ਵਿੱਚ ਆਧੁਨਿਕ ਸੰਸਾਰ ਵਿੱਚ ਜਿਵੇਂ ਜਿਵੇਂ ਟੈਕਨੋਲੋਜੀ ਜਾਂ ਫਿਰ ਆਵਾਜਾਈ ਦੇ ਸਾਧਨਾਂ ਦਾ ਵਿਸਥਾਰ ਹੁੰਦਾ ਜਾ ਰਿਹਾ ਹੈ ਇਹਦੇ ਨਾਲ ਪੰਜਾਬੀ ਭਾਸ਼ਾ ਨੂੰ ਵੀ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਵਿੱਚ ਮੁੱਖ ਤੌਰ 'ਤੇ ਜੇਕਰ ਆਪਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਕੋਈ ਜੋ ਇਸ ਦਾ ਮੂਲ ਰੂਸ ਰੂਪ ਪੰਜਾਬੀ ਭਾਸ਼ਾ ਦਾ ਮੂਲ ਸਰੂਪ ਜੋ ਪਿੰਡਾਂ ਵਿੱਚ ਬੋਲਿਆ ਜਾਂਦਾ ਹੈ ਉਹ ਸਰੂਪ ਜਦੋਂ ਬੰਦਾ ਕਿਤੇ ਹੋਰ ਦੇਸ਼ ਦੇ ਵਿੱਚ ਚਲਾ ਜਾਂਦਾ ਹੈ ਤਾਂ ਉੱਥੋਂ ਦੀ ਮੁੱਖ ਭਾਸ਼ਾ ਹਾਵੀ ਹੋਣ ਕਰਕੇ ਉਹਦੇ 'ਤੇ ਉਸਦਾ ਮ ਮੁੱਖ ਸਰੂਪ ਬਦਲ ਰਿਹਾ ਹੈ ਅਗਰ ਭਾਰਤੀ ਪੰਜਾਬ ਦੀ ਵੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਵੀ ਕਿਉਂਕਿ ਫਿਲਮਾਂ ਜਾਂ ਟੀ ਵੀ ਨਾ ਨਾਟਕਾਂ ਅਤੇ ਆਮ ਜੋ ਤੁਸੀਂ ਆਮ ਬੋਲ ਚਾਲ ਦੇ ਵਿੱਚ ਜਾਂ ਮਸ਼ਹੂਰੀਆਂ ਦੀ ਜਾਂ ਹੋਰ ਗੱਲ ਕਰੀਏ ਤਾਂ ਇਹਦੇ ਵਿੱਚ ਇੰਗ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਦਾ ਕਾਫੀ ਜ਼ਿਆਦਾ ਪ੍ਰਭਾਵ ਆ ਰਿਹਾ ਹੈ ਇਸ ਕਰਕੇ ਕਾਫੀ ਜ਼ਿਆਦਾ ਸ਼ਬਦ ਪੰਜਾਬੀ ਦੇ ਵਿੱਚ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੇ ਵੀ ਸ਼ਾਮਿਲ ਹੋ ਰਹੇ ਹਨ ਤਾਂ ਇਹੀ ਮੁੱਖ ਚੁਣੌਤੀਆਂ ਹਨ ਜੋ ਕਿ ਪੰਜਾਬੀ ਭਾਸ਼ਾ ਨੂੰ ਪੇਸ਼ ਆ ਰਹੀਆਂ ਹਨ